ਕਿਫਾਇਤੀ ਆਵਾਜ਼ਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਾਫੀ ਖੇਤਰ ਨੂੰ ਪ੍ਰਭਾਵਿਤ ਹਰ ਖੇਤਰ ਦੇ ਵਿੱਚ ਤਕਰੀਬਨ ਪ੍ਰਭਾਵਿਤ ਕੀਤਾ ਹੈ ਜਿਹੜੀ ਟ੍ਰਾਂਸਪੋਰਟ ਮਹਿੰਗੀ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ ਸਿੱਖਿਆ ਦੀ ਗੱਲ ਕਰੀਏ ਨੌਕਰੀ ਦੇ ਖੇਤਰ 'ਚ ਗੱਲ ਕਰੀਏ ਜਾਂ ਕਿਸੇ ਹੋਰ ਖੇਤਰ 'ਚ ਗੱਲ ਕਰੀਏ ਅਤੇ ਜਿਹੜੇ ਟ੍ਰਾਂਸਪੋਰਟ ਦੇ ਕਿਰਾਏ ਆ ਜਿਵੇਂ ਬੱਸਾਂ ਦਾ ਕਿਰਾਇਆ ਜਾਂ ਟਰੇਨ ਦਾ ਕਿਰਾਇਆ ਇਹ ਦਿਨ ਪਰ ਦਿਨ ਪ੍ਰਤੀ ਵੱਧ ਰਹੇ ਨੇ ਅਤੇ ਸਰਕਾਰ ਨੂੰ ਕੁਛ ਹੱਦ ਤੱਕ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਕੋਈ ਨਾ ਕੋਈ ਤਰੀਕਾ ਲੱਭਣਾ ਚਾਹੀਦਾ ਹੈ ਕਿ ਇਹਨਾਂ ਨੂੰ ਘਟਾਇਆ ਜਾ ਸਕੇ ਜਿਵੇਂ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਲੇਡਿਜ਼ ਵਾਸਤੇ ਉਹਨਾਂ ਦੀ ਟਿਕਟ ਹੈ ਜਿਹੜੀ ਜੀਰੋ ਕੀਤੀ ਗਈ ਹੈ ਉਹਨਾਂ ਤੋਂ ਕੋਈ ਕਿਰਾਇਆਂ ਨਹੀਂ ਵਸੂਲਿਆ ਜਾਂਦਾ ਅਤੇ ਮਰਦਾਂ ਵਾਸਤੇ ਵੀ ਇਹਨਾਂ ਨੂੰ ਕੁਛ ਨਾ ਕੁਛ ਇੱਦਾਂ ਦਾ ਕਰਨਾ ਚਾਹੀਦਾ ਹੈ ਕਿ ਥੋੜ੍ਹੀ ਬਹੁਤੀ ਛੂਟ ਦਿੱਤੀ ਜਾ ਸਕੇ ਅਤੇ ਗੱਲ ਕਰੀਏ ਜਿਹੜੇ ਆਟੋ ਰਿਕਸ਼ਾ ਵਾਲੇ ਨੇ ਉਹ ਬੜੇ ਪੈਸੇ ਵਸੂਲਦੇ ਨੇ ਕਿਉੰਕਿ ਲੋਕਾਂ ਨੂੰ ਜਿਹੜੇ ਹੋਰ ਸਟੇਟ ਤੋਂ ਲੋਕ ਆਉਂਦੇ ਨੇ ਉਹਨਾਂ ਨੂੰ ਲੌਕਲ ਉਨ੍ਹਾਂ ਦੀ ਨੋਲੇਜ਼ ਨਹੀਂ ਹੁੰਦੀ ਹੈਗੀ ਜਿਸ ਕਰਕੇ ਉਹ ਆਪਣੀ ਮਨਮਰਜ਼ੀ ਦਾ ਕਿਰਾਇਆ ਵਸੂਲਦੇ ਨੇ ਅਤੇ ਗੱਲ ਕਰੀਏ ਜਿਹੜੇ ਐਂਬੂਲੈਂਸ ਐ ਇਹ ਪ੍ਰਾਈਵੇਟ ਹੋਸਪੀਟਲ ਵਾਲੇ ਨੇ ਇਹ ਕਾਫ਼ੀ ਕਿਰਾਇਆ ਵਸੂਲਦੇ ਨੇ ਕਿਉਂਕਿ ਸਾਡੀ ਮਜਬੂਰੀ ਹੁੰਦੀ ਹੈ ਉੱਥੇ ਅਸੀਂ ਕੁਝ ਕਹਿ ਨਹੀਂ ਸਕਦੇ ਅਤੇ ਨੌਕਰੀ ਹੈ ਜਿਹੜੇ ਨੌਕਰੀ ਦੀ ਗੱਲ ਕਰੀਏ ਜਿਹੜੇ ਮਤਲਬ ਕਿ ਲੋਕ ਪਿੰਡਾਂ ਤੋਂ ਆਉਂਦੇ ਨੇ ਰੁਜ਼ਗਾਰ ਕਰਨ ਸ਼ਹਿਰਾਂ ਵੱਲ ਆਉਂਦੇ ਨੇ ਤਾਂ ਉੱਥੇ ਕੋਈ ਪਰੋਪਰ ਸਰਕਾਰ ਧਿਆਨ ਨਹੀਂ ਦਿੰਦੀ ਹੈਗੀ ਅਤੇ ਉੱਥੇ ਅਵਾਜਾਈ ਦੇ ਜਿਹੜੇ ਪ੍ਰਾਈਵੇਟ ਬੱਸਾਂ ਨੇ ਤਾਂ ਉਹ ਆਪਣੀ ਮਨ ਮਰਜ਼ੀ ਨਾਲ ਕਿਰਾਇਆ ਵਸੂਲਦੇ ਨੇ